ਪੰਜਾਬ ਰਾਜ ਕਾਫੀ ਐਸੇ ਖੇਤਰ ਹਨ ਜਿਨ੍ਹਾਂ ਵੀ ਜਿਹੜੇ ਸੈਲਾਨੀ ਅਕਰਸ਼ਣ ਦਾ ਕੇਂਦਰ ਹਨ ਜਿਹੜੇ ਕਿ ਘੁੰਮਣ ਫਿਰਨ ਲਈ ਅਤੇ ਦੇਖਣ ਲਈ ਬਹੁਤ ਹੀ ਵਧੀਆ ਜਗ੍ਹਾ ਹਨ ਇਹਨਾਂ ਵਿੱਚ ਕੰਮ ਮੁੱਖ ਤੌਰ 'ਤੇ ਅੰਬਰਸਰ ਦਾ ਗੋਲ ਗੋਲਡਨ ਟੈਂਪਲ ਪਟਿਆਲਾ ਦਾ ਕਾਲੀ ਮਾਤਾ ਮੰਦਰ ਅਤੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਕਾਫੀ ਜ਼ਿਆਦਾ ਜਗ੍ਹਾ ਹਨ ਜੋ ਦੇਖਣ ਯੋਗ ਹਨ ਜਿਵੇਂ ਕਿ ਛੱਤਬੀੜ ਚਿੜੀਆ ਘਰ ਇਹ ਦੇ ਪੰਜਾਬ ਸਰਕਾਰ ਨੂੰ ਇਨ੍ਹਾਂ ਖੇਤਰਾਂ ਦੀ ਸਾਂਭ ਸੰਭਾਲ ਦੀ ਅਤੇ ਇਹਨਾਂ ਦੇ ਖੇਤਰਾਂ ਵਿੱਚੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਕਾਫੀ ਜ਼ਿਆਦਾ ਸਮੇਂ ਸਮੇਂ 'ਤੇ ਪ੍ਰੋਗਰਾਮ ਚਲਾਉਣੇ ਜ਼ਰੂਰੀ ਹਨ ਤਾਂ ਜੋ ਆਮ ਪਬਲਿਕ ਨੂੰ ਅਤੇ ਦੁਨੀਆ ਦੇ ਲੋਕਾਂ ਨੂੰ ਇਹਨਾਂ ਕੇਂਦਰਾਂ ਦੀ ਜਾਣਕਾਰੀ ਮਿਲੇ ਸੈਲਾਨੀ ਵੱਧ ਤੋਂ ਵੱਧ ਇਹਨਾਂ ਸ ਸਟੇਸ਼ਨਾਂ ਨੂੰ ਦੇਖਣ ਲਈ ਪੰਜਾਬ ਵਿੱਚ ਆਉਣ ਅਤੇ ਜਿਸ ਲਈ ਜਿਹੜਾ ਸੈਰ ਸਪਾਟਾ ਦਾ ਜੋ ਆਪਣਾ ਇੰਡਸਟਰੀ ਹੈਗੀ ਆ ਇਹ ਵੀ ਅੱਛੀ ਤਰ੍ਹਾਂ ਗਰੋ ਕਰੇ ਇਸ ਲਈ ਵਿਸ਼ੇਸ਼ ਤੌਰ 'ਤੇ ਕਦਮ ਚੁੱਕਣੇ ਜ਼ਰੂਰੀ ਹਨ